ਸਤਿ ਸ਼੍ਰੀ ਅਕਾਲ ਸਰ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਕਾਰਤਿਕ ਬੋਲ ਰਿਹਾ ਹਾਂ ਅਤੇ ਸਰ ਪਠਾਨਕੋਟ ਵਿੱਚ ਕਾਫੀ ਆਕਰਸ਼ਿਤ ਚੀਜ਼ਾਂ ਹਨ ਜੋ ਕਿ ਸੈਲਾਨੀਆਂ ਨੂੰ ਕਾਫੀ ਆਕਰਸ਼ਿਤ ਕਰਦੀਆਂ ਹਨ ਜਿਵੇਂ ਕਿ ਸਰ ਮਿੰਨੀ ਗੋਆ ਹੋ ਗਿਆ ਮਿੰਨੀ ਗੋਆ ਸਰ ਕਾਫੀ ਵਧੀਆ ਔਰ ਫੇਮਸ ਜਗ੍ਹਾ ਹੈਗੀ ਆ ਉਸ ਦੇ ਨਾਲ ਹੀ ਸਰ ਮੁਕਤੇਸ਼ਵਾਰ ਧਾਮ ਪੈ ਜਾਂਦਾ ਹੈ ਜੋ ਕਿ ਸ਼ਿਵ ਮੰਦਿਰ ਹੈਗਾ ਔਰ ਉੱਥੇ ਕਾਫੀ ਦੂਰੋਂ ਦੂਰੋਂ ਕਾਫੀ ਦੂਰੋਂ ਦੂਰੋਂ ਆਉਂਦੇ ਯਾਤਰੀ ਆਉਂਦੇ ਹੈਗੇ ਆ ਮੱਥਾ ਟੇਕਣ ਔਰ ਮਿੰਨੀ ਗੋਆ ਵੀ ਕਾਫੀ ਕਾਫੀ ਯਾਤਰੀ ਸ ਉੱਥੇ ਘੁੰਮਣ ਫਿਰਨ ਆਉਂਦੇ ਹਨ ਜੋ ਕਿ ਉੱਥੇ ਕਾਫੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਸਰਕਾਰ ਵੱਲੋਂ ਜਿਸ ਨਾਲ ਜਿਸ ਨਾਲ ਸਾਡੇ ਖਾਣ ਪੀਣ ਦਾ ਬੰਦੋਬਸਤ ਔਰ ਘੁੰਮਣ ਦਾ ਬੰਦੋਬਸਤ ਔਰ ਡਰਾਈਵਿੰਗ ਦਾ ਬੰਦੋਬਸਤ ਕਾਫੀ ਵਧੀਆ ਤਰੀਕੇ ਨਾਲ ਕੀਤਾ ਗਿਆ ਔਰ ਸਰਕਾਰ ਵੱਲੋਂ ਸਾਨੂੰ ਪਠਾਨਕੋਟ ਦੇ ਵਿੱਚ ਸਿਟੀ ਸੈਂਟਰ ਮੁਹੱਈਆ ਕਰਵਾਇਆ ਗਿਆ ਸਿਟੀ ਸੈਂਟਰ ਵਿੱਚ ਸਾਨੂੰ ਘੁੰਮਣ ਲਈ ਕਾਫੀ ਚੀਜ਼ਾਂ ਔਰ ਦੇਖਣ ਲਈ ਸਿਨੇਮਾ ਹੋਲ ਵੀ ਦਿੱਤਾ ਗਿਆ ਔਰ ਖਾਣ ਪੀਣ ਲਈ ਡੋਮੀਨੋਜ ਵੀ ਦਿੱਤਾ ਗਿਆ ਜੋ ਕਿ ਸਾਨੂੰ ਹਰ ਟਾਈਮ ਚੌਵੀ ਘੰਟੇ ਉਪਲੱਬਧ ਕਰਵਾਇਆ ਗਿਆ ਹੈ ਜਿਸ ਕਰਕੇ ਕੋਈ ਵੀ ਸੈਲਾਨੀ ਉੱਥੇ ਆ ਕੇ ਕਿਸੀ ਵੀ ਟਾਈਮ ਕੁਝ ਵੀ ਖਾ ਪੀ ਕੇ ਕੁਝ ਵੀ ਘੁੰਮ ਫਿਰ ਕੇ ਦੇਖ ਸਕੇ ਔਰ ਕੁਝ ਵੀ ਮੂਵੀ ਦੇਖ ਸਕਦਾ ਹੈ ਜਿਸ ਨਾਲ ਉਹਨਾਂ ਨੂੰ ਕਾਫੀ ਕਾਫੀ ਆਕਰਸ਼ਿਤ ਹੁੰਦੇ ਹਨ ਸੈਲਾਨੀ ਔਰ ਕਾਫੀ ਇੰਟਰਸਟ ਪੈਦਾ ਹੁੰਦਾ ਹੈ ਉਹਨਾਂ ਦਾ ਪਠਾਨਕੋਟ ਵਿੱਚ ਔਰ ਪਠਾਨਕੋਟ ਬਹੁਤ ਹੀ ਵਧੀਆ ਵਧੀਆ ਸਿਟੀ ਹੈਗੀ ਹੈ ਜਿਸ ਨਾਲ ਸਾਨੂੰ ਕਾਫੀ ਸੈਲਾਨੀਆਂ ਦਾ ਆਉਣ ਜਾਣ ਔਰ ਆਕਰਸ਼ਿਤ ਪੈਦਾ ਹੁੰਦਾ ਹੈ